ਟਿਊਬਵੈੱਲ ਦੀ ਲੋੜ ਤਾਂ ਉਸ ਟੈਮ ਸ਼ੁਰੂ ਹੋਈ ਜਿਸ ਟੈਮ ਹਰੀ ਕ੍ਰਾਂਤੀ ਜ਼ਿਆਦਾ ਸਟਾਰਟ ਹੋਈ ਸਾਡੇ ਪੰਜਾਬ ਦੇ ਵਿੱਚ ਟਿਊਬਵੈੱਲ ਇੱਕ ਤਰ੍ਹਾਂ ਦੀ ਮੋਟਰ ਹੈ ਜੋ ਅਸੀਂ ਦਸਵੀਂ 'ਚ ਪੜ੍ਹਦੇ ਸ ਸੀਗੇ ਉਹਦੇ ਵਿੱਚ ਕਿਆ ਹੁੰਦੀ ਇੱਕ ਚੁੰਬਕ ਦੀ ਤਰ੍ਹਾਂ ਕੰਮ ਕਰਦੀ ਹੈ ਉਹ ਜਿੱਦਾਂ ਕਿ ਉਹਨੂੰ ਬਿਜਲੀ ਇੱਕ ਕੋਇਲ ਹੁੰਦੀ ਉਹਦੇ ਆਲੇ ਦੁਆਲੇ ਤਾਂਬਾ ਲਪੇਟਿਆ ਹੁੰਦਾ ਵਿੱਚ ਚੁੰਬਕ ਹੁੰਦੀ ਜਿਹੜੇ ਕੋਇਲ ਵਿੱਚ ਕਰੰਟ ਪੈਦਾ ਕਰਦੇ ਹੈ ਤਾਂ ਕੋਇਲ ਜਿਹੜੀ ਹੈ ਉਹ ਇੱਕ ਚੁੰਬਕ ਦੀ ਤਰ੍ਹਾਂ ਕੰਮ ਕਰਦੀ ਚੁੰਬਕ ਦਾ ਨੋਰਥ ਸਿਰਾ ਸਾਊਥ ਸਿਰੇ ਵੱਲ ਨੂੰ ਅਤੇ ਸੋਊ ਸਾਊਥ ਸਿਰਾ ਨੋਰਥ ਸਿਰੇ ਵੱਲ ਨੂੰ ਖਿੱਚਦਾ ਅਤੇ ਖਿੱਚਣ ਕਰਕੇ ਉਹ 'ਚ ਕਿਆ ਹੁੰਦਾ ਆਰਮੇਚਰ ਦੇ ਵਿੱਚ ਫਸੀ ਹੋਣ ਕਰਕੇ ਉਹ ਗੋਲ ਗੋਲ ਘੁੰਮਣ ਲੱਗ ਪੈਂਦੀ ਗੋਲ ਗੋਲ ਘੁੰਮਣ ਕਰਕੇ ਉਹਦੇ ਨਾਲ ਇੱਕ ਪੱਖਾ ਲਗਾਇਆ ਹੁੰਦਾ ਜਿਹੜਾ ਕਿ ਵੈਕਿਊਮ ਦੀ ਤਰ੍ਹਾਂ ਕੰਮ ਕਰਦਾ ਜਦੋਂ ਧਰਤੀ ਵਿੱਚ ਪਾਈ ਜਾਂਦੀ ਹੈ ਤਾਂ ਪਾਣੀ ਬਾਹਰ ਕੱਢ ਕੇ ਸੁੱਟਦੀ ਹੈ ਉਹ ਇਸ ਤਰ੍ਹਾਂ ਟਿਊਬਵੈੱਲ ਕੰਮ ਕਰਦਾ ਹੈ ਸਾਡੇ ਪਿੰਡ ਵੀ ਇੱਕ ਵੱਡਾ ਖੂਹ ਸੀ ਇੱਕ ਸਾਡੇ ਘਰ ਤੋਂ ਦੋ ਸੌ ਕੁ ਮੀਟਰ ਦੀ ਦੂਰੀ 'ਤੇ ਸੀ ਇੱਕ ਪਿੰਡ ਦੇ ਵਿੱਚ ਸੀ ਜੋ ਪੰਜ ਸੌ ਕੁ ਮੀਟਰ ਦੀ ਦੂਰੀ 'ਤੇ ਸੀ ਅਤੇ ਦੋ ਤਿੰਨ ਹੋਰ ਸਕੂ ਖੂਹ ਸੀ ਖੂਹ ਦਾ ਪਾਣੀ ਐਦਾਂ ਸੀ ਖੂਹ ਦਾ ਪਾਣੀ ਮੈਂ ਪੀਤਾ ਹੋਇਆ ਆਪਣੇ ਬਚਪਨ ਦੇ ਵਿੱਚ ਮੈਂ ਖੂਹ ਦੇ ਪਾਣੀ 'ਚ ਨਹਾਤਾ ਹੋਇਆਂ ਉਸ ਟੈਮ ਮੈਂ ਦੇਖਿਆ ਸੀਗਾ ਕਿ ਆਪਣੇ ਬ ਬਚਪਨ ਦੇ ਵਿੱਚ ਜਿਹੜੇ ਲੋਕ ਸੀ ਉੱਥੇ ਖੁਰਲੀਆਂ ਬਣਾਈਆਂ ਹੁੰਦੀਆਂ ਸਨ ਜਿੱਥੇ ਵਿੱਚ ਪਾਣੀ ਪਸ਼ੂਆਂ ਨੂੰ ਪਿਲਾਉਂਦੇ ਹੁੰਦੇ ਸਨ ਕਿਉਂਕਿ ਬੋਰ ਵਾਲਾ ਸਿਸਟਮ ਬਹੁਤ ਉਸ ਟੈਮ ਘੱਟ ਸੀ ਟੂਟੀਆਂ ਲੱਗੀਆਂ ਹੋਈਆਂ ਸਨ ਬਤ ਬਹੁਤ ਘੱਟ ਘੱਟ ਸਨ ਅਤੇ ਰੋਜ਼ਾਨਾ ਜੀਵਨ ਵਾਸਤੇ ਹੁਣ ਤਾਂ ਉਹਦੇ ਪਰ ਖੂਹ ਦੇ ਉੱਪਰ ਡਿਪੈਂਡ ਕੱਢਣਾ ਪੈਂਦਾ ਸੀ ਉਹ ਖੂਹ ਦੀ ਲਗਭਗ ਗਹਿਰਾਈ ਮੇਰੇ ਹਿਸਾਬ ਨਾਲ ਗਿਆਰ੍ਹਾਂ ਅਤੇ ਬਾਰ੍ਹਾਂ ਫੁੱਟ ਮੇਰੇ ਹਿਸਾਬ ਨਾਲ ਵੀਹ ਫੁੱਟ ਹੋ ਸਕਦੀ ਹੈ ਵੀਹ ਫੁੱਟ ਦੀ ਖੂਹ ਹੋਣ ਕਰਕੇ ਉਹਦੇ ਵਿੱਚ ਪਾਣੀ ਥੱਲੇ ਕੁਦਰਤੀ ਤਰੀਕੇ ਨਾਲ ਨਿਕਲਦਾ ਸੀ ਅਸੀਂ ਉਹ ਪੀਂਦੇ ਸਨ ਘਰ ਦੇ ਕੰਮ ਵਾਸਤੇ ਭਾਂਡੇ ਧੋਣੇ ਨਹਾਉਣਾ ਸਬਜ਼ੀ ਬਣਾਉਣੀ ਉੱਥੇ ਹੀ ਫਰੈਸ਼ ਅਤੇ ਉਹ ਖੂਹ ਦਾ ਪਾਣੀ ਬਹੁਤ ਮਿੱਠਾ ਹੁੰਦਾ ਸੀ ਬਹੁਤ ਸਾਰੇ ਲੋਕ ਉੱਥੇ ਸਵੇਰੇ ਸਵੇਰੇ ਬੜੇ ਇਕੱਠੇ ਹੋਣਾ ਉੱਥੇ ਲੋਕਾਂ ਨੇ ਬਹੁਤ ਮਜ਼ਾ ਆਉਂਦਾ ਸੀ